ਸੁਨੀਲ ਕੁਮਾਰ ਮਿਰਜ਼ਾਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਾਂ ਆਪਣੇ ਘਰ ਨੈਟ ਇੰਟਰਨੈਟ ਦੀ ਸੇਵਾ ਲਈ ਹੈ ਜੋ ਕਿ ਕਾਫੀ ਸਮੇਂ ਤੋਂ ਬੰਦ ਪਈ ਹੈ ਸਾਡਾ ਕਈ ਤਰ੍ਹਾਂ ਦਾ ਕੰਮ ਰੁਕ ਗਿਆ ਹੈ ਜਿਵੇਂ ਬੱਚੇ ਪੜਦ੍ਹੇ ਹਨ ਹੋਰ ਵੀ ਮੇਰੇ ਦਫਤਰ ਦਾ ਕਈ ਤਰ੍ਹਾਂ ਦਾ ਕੰਮ ਰੁਕ ਚੁੱਕਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇੰਟਰਨੈਟ ਦੀ ਵਰਤੋਂ ਬਹੁਤ ਹੀ ਕਰਦਾ ਹਾਂ ਅਤੇ ਕਾਫੀ ਦੇਰ ਤੋਂ ਬੰਦ ਹੋ ਚੁੱਕੀ ਹੈ ਮੈ ਤੁਹਾਡਾ ਧਿਆਨ ਇਸ ਇਸ ਬਾਰੇ ਪਹਿਲਾਂ ਵੀ ਦਵਾਇਆ ਹੈ ਪਰ ਤੁਸੀਂ ਇਸ ਨੂੰ ਠੀਕ ਨਹੀਂ ਕੀਤਾ ਹੁਣ ਮੈਂ ਇੱਕ ਵਾਰ ਫਿਰ ਬੇਨਤੀ ਕਰ ਰਿਹਾ ਹਾਂ ਕਿ ਮੇਰਾ ਨੈਟ ਠੀਕ ਕੀਤਾ ਜਾਏ ਜੋ ਵੀ ਉਸਦੀ ਫੀਸ ਹੋਵੇਗੀ ਮੈਂ ਉਸ ਨੂੰ ਪੇ ਕਰ ਦੇਵਾਂਗਾ ਅਤੇ ਮੈਨੂੰ ਆਪਣੇ ਕੰਮ ਕਾਜ ਜਲਦੀ ਤੋਂ ਜਲਦੀ ਕਰਨ ਵਿੱਚ ਮੈਂ ਤੁਸੀਂ ਮੇਰੀ ਮਦਦ ਅਤੇ ਸਹਾਇਤਾ ਕਰੋ ਜਦੋਂ ਇਹ ਠੀਕ ਹੋ ਗਿਆ ਤਾਂ ਸਾਡੇ ਬੱਚੇ ਵੀ ਪੜ੍ਹ ਸਕਣਗੇ ਮੇਰੇ ਦਫਤਰ ਦਾ ਕੰਮ ਵੀ ਪੂਰਾ ਹੋ ਸਕੇਗਾ ਇਸ ਲਈ ਮੈਂ ਤੁਹਾਨੂੰ ਬਾਰ ਬਾਰ ਬੇਨਤੀ ਕਰ ਰਿਹਾ ਹਾਂ ਕਿ ਮੇਰਾ ਨੈਟ ਕਨੈਕਸ਼ਨ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਧੰਨਵਾਦ ਸੁਨੀਲ ਕੁਮਾਰ